ਜ਼ਿਲ੍ਹੇ ਵਿੱਚ ਸਰਕਾਰੀ ਦਫਤਰਾਂ ਦੁਆਰਾ ਪੇਸ਼ ਕੀਤੀ ਸੇਵਾ ਬਹੁਤ ਹੀ ਵਧੀਆ ਅਤੇ ਅਨੁਕੂਲ ਹੁੰਦੀ ਹੈ ਕਿਉਂਕਿ ਇਸ ਨਾਲ ਬਹੁਤ ਸਾਰੇ ਲੋੜਵੰਦਾਂ ਨੂੰ ਸਹਾਇਤਾ ਮਿਲਦੀ ਹੈ ਜਿਵੇਂ ਕਿ ਤਰ੍ਹਾਂ ਕੁਝ ਜਿਵੇਂ ਕਿ ਪਿਛਲੇ ਸਾਲ ਹੜ੍ਹ ਆਉਣ ਦੇ ਕਾਰਨ ਬਹੁਤ ਸਾਰੇ ਲੋਕ ਸੜਕਾਂ 'ਤੇ ਆ ਚੁੱਕੇ ਸਨ ਅਤੇ ਉਨ੍ਹਾਂ ਨੂੰ ਖਾਣ ਪੀਣ ਲਈ ਅਤੇ ਪਹਿਨਣ ਲਈ ਕੁਛ ਵੀ ਨਹੀਂ ਸੀ ਰਹਿ ਗਿਆ ਇਸ ਵਿੱਚ ਰੂਪ ਰੂਪਨਗਰ ਸਰਕਾਰ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਉਨ੍ਹਾਂ ਨੂੰ ਖਾਣ ਪੀਣ ਲਈ ਰਾਸ਼ਨ ਪ੍ਰਦਾਨ ਕੀਤਾ ਅਤੇ ਪਹਿਨਣ ਲਈ ਕੱਪੜੇ ਵੀ ਪ੍ਰਦਾਨ ਕੀਤੇ ਇੱਥੋਂ ਤੱਕ ਕਿ ਉਨ੍ਹਾਂ ਨੇ ਉਨ੍ਹਾਂ ਲਈ ਸਰਕਾਰੀ ਕੁਆਰਟਰ ਵਿੱਚ ਜਗ੍ਹਾ ਵੀ ਜਗ੍ਹਾ ਦਾ ਵੀ ਪ੍ਰਬੰਧ ਕੀਤਾ ਤਾਂਂ ਜੋ ਉਹ ਮੀਂਹ ਦੇ ਮੀਂਹ ਤੋਂ ਬੱਚ ਕੇ ਉੱਥੇ ਰਹਿ ਸਕਣ